ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਵਿੱਚ ਸੱਚ ਮੁੱਚ ਚੁਣੌਤੀਆਂ ਹਨ ਅਤੇ ਸਹੂਲਤਾਂ ਤੱਕ ਨਾ ਕਾਫ਼ੀ ਪਹੁੰਚਾਂ ਉਹਨਾਂ ਵਿੱਚੋਂ ਇੱਕ ਹੋ ਸਕਦੀ ਹੈ ਕਈ ਕਾਰਨ ਇਸ ਮੁੱਦੇ ਵਿੱਚ ਯੋਗਦਾਨ ਪਾਉਂਦੇ ਹਨ ਸਹੂਲਤਾਂ ਦੀ ਘਾਟ ਬਹੁਤ ਸਾਰੇ ਭਾਈਚਾਰਿਆਂ ਵਿੱਚ ਖਾਸ ਤੌਰ 'ਤੇ ਪੇਂਡੂ ਜਾਂ ਘੱਟ ਸੇਵਾ ਵਾਲੇ ਖੇਤਰਾਂ ਵਿੱਚ ਖੇਡ ਸਹੂਲਤਾਂ ਜਿਵੇਂ ਕਿ ਖੇਡ ਮੈਦਾਨ ਖੇਡਾਂ ਦੇ ਮੈਦਾਨ ਅਤੇ ਮਨੋਰੰਜਨ ਕੇਂਦਰਾਂ ਦੀ ਘਾਟ ਹੈ ਇਹਨਾਂ ਸਹੂਲਤਾਂ ਤੱਕ ਪਹੁੰਚ ਤੋਂ ਬਿਨਾਂ ਨੌਜਵਾਨਾਂ ਕੋਲ ਸੰਗਠਿਤ ਖੇਡ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਸੀਮਤ ਮੌਕੇ ਹੋ ਸਕਦੇ ਹਨ ਸੀਮਿਤ ਸਰੋਤ ਸਕੂਲਾਂ ਅਤੇ ਭਾਈਚਾਰਕ ਸੰਸਥਾਵਾਂ ਵਿੱਚ ਵਿੱਤੀ ਰੁਕਾਵਟਾਂ ਅਤੇ ਬਜਟ ਵਿੱਚ ਕਟੌਤੀ ਦੇ ਨਤੀਜੇ ਵਜੋਂ ਖੇਡ ਪ੍ਰੋਗਰਾਮਾਂ ਅਤੇ ਸਾਜੋ ਸਮਾਨ ਲਈ ਫੰਡ ਘੱਟ ਹੋ ਸਕਦੇ ਹਨ ਇਹ ਖੇਡ ਪ੍ਰੋਗਰਾਮਾਂ ਕੋਚਿੰਗ ਸਟਾਫ ਅਤੇ ਸਾਜੋ ਸਮਾਨ ਦੀ ਗੁਣਵੱਤਾ ਸਟਾਫ ਅਤੇ ਸਾਜੋ ਸਮਾਨ ਦੀ ਗੁਣਵੱਤਾ ਅਤੇ ਉਪਲਬਧਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਨਾਲ ਨੌਜਵਾਨਾਂ ਲਈ ਭਾਗ ਲੈਣਾ ਚੁਣੌਤੀਪੂਰਨ ਹੋ ਸਕਦਾ ਹੈ ਹੋਰ ਗਤੀਵਿਧੀਆਂ ਦੇ ਨਾਲ ਮੁਕਾਬਲਾ ਅੱਜ ਦੇ ਤੇਜ਼ ਰਫਤਾਰ ਸੰਸਾਰ ਵਿੱਚ ਨੌਜਵਾਨਾਂ ਨੂੰ ਅਕਾਦਮਿਕ ਵਚਨਵਧਤਾਵਾਂ ਪਾਠਕ੍ਰਮਾਂ ਤੋਂ ਬਾਹਰਲੀਆਂ ਗਤੀਵਿਧੀਆਂ ਅਤੇ ਸਕਰੀਨ ਸਮੇਂ ਤੋਂ ਪ੍ਰਤੀਯੋਗੀ ਮੰਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖੇਡਾਂ ਦੀ ਭਾਗੀਦਾਰੀ ਹੋਰ ਤਰਜੀਹਾਂ ਨੂੰ ਪਿੱਛੇ ਛੱਡ ਸਕਦੀ ਹੈ ਜਿਸ ਨਾਲ ਸਰੀਰਕ ਗਤੀਵਿਧੀ ਵਿੱਚ ਦਿਲਚਸਪੀ ਅਤੇ ਰੁਚੀ ਘੱਟ ਜਾਂਦੀ ਹੈ ਪ੍ਰਮੋਸ਼ਨ ਦੀ ਕਮੀ ਸਪੋਰਟਸ ਨੂੰ ਸੁਮਦਾਇਆਂ ਸਕੂਲਾਂ ਅਤੇ ਮੀਡੀਆ ਆਊਟਲੈਟਾਂ ਵਿੱਚ ਹਮੇਸ਼ਾਂ ਲੋੜੀਂਦੀ ਤਰੱਕੀ ਅਤੇ ਮਾਨਤਾ ਪ੍ਰਾਪਤ ਨਹੀਂ ਹੋ ਸਕਦੀ ਉੱਚਿੱਤ ਤਰੱਕੀ ਅਤੇ ਉਤਸ਼ਾਹ ਤੋਂ ਬਿਨਾਂ ਨੌਜਵਾਨ ਖੇਡਾਂ ਵਿੱਚ ਹਿੱਸਾ ਲੈਣ ਲਈ ਘੱਟ ਪ੍ਰੇਰਿਤ ਹੋ ਸਕਦੇ ਹਨ ਅਤੇ ਉਪਲਬਧ ਮੌਕਿਆਂ ਬਾਰੇ ਜਾਣੂ ਨਹੀਂ ਹੋ ਸਕਦੇ ਹਨ ਨੌਜਵਾਨਾਂ ਵਿੱਚ ਖੇਡਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਈ ਰਣਨੀਤੀਆਂ ਲਾਗੂ ਕੀਤੀਆਂ ਜਾ ਸਕਦੀਆਂ ਹਨ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਸਰਕਾਰਾਂ ਸਕੂਲਾਂ ਅਤੇ ਕਮਿਊਨਿਟੀ ਸੰਸਥਾਵਾਂ ਨੂੰ ਖੇਡਾਂ ਦੇ ਮੈਦਾਨਾਂ ਖੇਡਾਂ ਦੇ ਜਿੰਮਾਂ ਅਤੇ ਮਨੋਰੰਜਨ ਕੇਂਦਰਾਂ ਸਮੇਤ ਖੇਡਾਂ ਦੀਆਂ ਸਹੂਲਤਾਂ ਦੇ ਨਿਰਮਾਣ ਅਤੇ ਰੱਖ ਰਖਾਅ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਪਹੁੰਚਯੋਗ ਅਤੇ ਚੰਗੀ ਤਰ੍ਹਾਂ ਲੈੱਸ ਸਹੂਲਤਾਂ ਪ੍ਰਦਾਨ ਕਰਨਾ ਯਕੀਨੀ ਬਣਾਉਣਾ ਬਣਾਉਂਦਾ ਹੈ ਕਿ ਨੌਜਵਾਨਾਂ ਨੂੰ ਸਰੀਰਕ ਗਤੀਵਿਧੀ ਵਿੱਚ ਸ਼ਾਮਿਲ ਹੋਣ ਦੇ ਮੌਕੇ ਮਿਲੇ ਉਪਕਰਣਾਂ ਅਤੇ ਸਰੋਤਾਂ ਤੱਕ ਪਹੁੰਚ ਯਕੀਨੀ ਬਣਾਓ ਕਿ ਖੇਡਾਂ ਦੇ ਪ੍ਰੋਗਰਾਮਾਂ ਕੋਲ ਭਾਗੀਦਾਰੀ ਦਾ ਸਮਰਥਨ ਕਰਨ ਲਈ ਲੋੜੀਂਦੇ ਸਾਜੋ ਸਮਾਨ ਵਰਦੀਆਂ ਅਤੇ ਸਰੋਤਾਂ ਤੱਕ ਪਹੁੰਚ ਹੈ ਵਿੱਤੀ ਸਹਾਇਤਾ ਪ੍ਰੋਗਰਾਮ ਸਾਜੋ ਸਮਾਨ ਦਾਨ ਅਤੇ ਸਥਾਨਕ ਕਾਰੋਬਾਰਾਂ ਨਾਲ ਸਾਂਝੇਦਾਰੀ ਨੌਜਵਾਨਾਂ ਅਥਲੀਟਾਂ ਲਈ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ ਸਰੀਰਕ ਸਿੱਖਿਆ ਦਾ ਪ੍ਰਚਾਰ ਸਰੀਰਕ ਸਿੱਖਿਆ ਪ੍ਰੋਗਰਾਮਾਂ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਿਲ ਕਰੋ ਅਤੇ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਨਿਯਮਿਤ ਸਰੀਰਕ ਗਤੀਵਿਧੀ ਦੇ ਮਹੱਤਵ ਨੂੰ ਉਤਸ਼ਾਹਿਤ ਕਰੋ ਵੀ ਇਹ ਕਲਾਸਾਂ ਨੂੰ ਵਿਦਿਆਰਥੀਆਂ ਨੂੰ ਮੁੱਢਲੇ ਅੰਦੋਲਨ ਦੇ ਹੁਨਰ ਸਿੱਖਣ ਖੇਡਾਂ ਵਿੱਚ ਭਾਗ ਲੈਣ ਅਤੇ ਸਰੀਰਕ ਤੰਦਰੁਸਤੀ ਲਈ ਜੀਵਨ ਭਰ ਪ੍ਰਸ਼ੰਸਾ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਭਾਈਚਾਰਕ ਸ਼ਮੂਲੀਅਤ ਖੇਡਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਅਥਲੀਟਾਂ ਲਈ ਸਹਾਇਕ ਮਾਹੌਲ ਬਣਾਉਣ ਲਈ ਮਾਪਿਆਂ ਅਧਿਆਪਕਾਂ ਕੋਚਾਂ ਅਤੇ ਕਮਿਊਨਿਟੀ ਲੀਡਰਾਂ ਨੂੰ ਸ਼ਾਮਿਲ ਕਰੋ